ਕੀ ਤੁਸੀਂ ਆਪਣੇ ਰਾਜ ਦੇਸ਼ ਤੋਂ ਬਾਹਰ ਯਾਤਰਾ ਕੀਤੀ ਹੈ ਤੁਹਾਡੀ ਯਾਤਰਾ ਦਾ ਕੀ ਉਦੇਸ਼ ਹੈ ਹਾਂਜੀ ਸਰ ਅਸੀਂ ਗਏ ਸੀਗੇ ਹਿਮਾਚਲ ਵੱਲ ਉੱਥੇ ਪਹਾੜੀ ਏਰੀਆ ਸੀ ਅਤੇ ਮੈਂ ਆਪਣੇ ਯਾਰਾਂ ਦੋਸਤਾਂ ਦੇ ਨਾਲ ਉੱਧਰ ਹਰੀਪੁਰ ਵੱਲ ਨੂੰ ਹਿਮਾਚਲ ਦੇ ਵੱਲ ਹਰੀਪੁਰ ਵੱਲ ਨੂੰ ਗਿਆ ਜੀ ਉੱਥੇ ਸਰ ਸਾਰਾ ਪਹਾੜੀ ਏਰੀਏ ਜੀ ਉਹਦੇ ਉੱਚੇ ਨੀਵੇਂ ਢਲਾਣਾਂ ਹਰੇ ਵਾਈ ਠੀਕ ਹੈ ਜੀ ਠੰਡ ਬਹੁਤ ਸਰ ਉੱਧਰ ਲੱਗਦੀ ਹੈ ਜੀ ਮੈਂ ਆਪਣੇ ਯਾਰਾਂ ਦੋਸਤਾਂ ਨੂੰ ਕਿਹਾ ਮੈਂ ਕਿਹਾ ਬੜਾ ਵਧੀਆ ਰੰਗੀਨ ਮੌਸਮ ਹੈ ਜੀ ਅਤੇ ਜੋ ਕਿ ਸ਼ਾਂਤ ਬਿਲਕੁਲ ਹਰੇ ਵਾਈ ਵਗੈਰਾ ਜਿਵੇਂ ਕਿ ਉੱਚੀਆਂ ਉੱਚੀਆਂ ਬਾਂਸ ਜੰਗਲ ਉੱਧਰ ਸਰ ਪਹਾੜਾਂ ਦੇ ਵਿੱਚ ਬਾਂਦਰ ਵਗੈਰਾ ਬਹੁਤ ਸਨ ਜੇਕਰ ਰਸਤਾ ਉਹ ਸਰ ਪਹਾੜੀ ਏਰੀਆ ਬਹੁਤ ਉੱਚਾ ਬਹੁਤ ਹੀ ਨੀਵਾਂ ਪਥਰੀਲਾ ਏਰੀਆ ਹਿਮਾਚਲ ਦੇ ਵਿੱਚ ਸਰ ਬਹੁਤ ਜ਼ਿਆਦਾ ਪਹਾੜੀ ਏਰੀਆ ਹੋਣ ਕਾਰਨ ਉੱਧਰ ਸਰ ਬਰਫ ਦੇ ਝਰਨੇ ਠੰਡਾ ਪਾਣੀ ਬਹੁਤ ਜ਼ਿਆਦਾ ਸਰ ਗਿਰਦਾ ਜਿਹਦੇ ਕਾਰਨ ਉੱਥੇ ਦਾ ਮੌ ਵਾਤਾਵਰਨ ਜ਼ਿਆਦਾਤਰ ਠੰਡਾ ਹੀ ਹੈ